ਨਮਸਤੇ ਜੀ ਮੇਰਾ ਨਾਮ ਸੋਨਿਕਾ ਮੈ ਗੁਰਦਾਸਪੁਰ ਤੋਂ ਰਹਿਣ ਵਾਲੀ ਹਾਂ ਪੰਜਾਬ ਤੋਂ ਅਤੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਕਿ ਮਤਲਬ ਕਿ ਤਕਨੀਕ ਤਕਨੀਕ ਨੇ ਤਾਂ ਕਾਫੀ ਕਾਫੀ ਤਰੱਕੀ ਕੀਤੀ ਹੋਈ ਹੈ ਜਿੱਦਾਂ ਕਿ ਮਤਲਬ ਕਿ ਹਰ ਚੀਜ਼ ਅੱਜ ਕੱਲ੍ਹ ਨੈਟ 'ਤੇ ਹੁੰਦੀ ਹੈ ਜਿੱਦਾਂ ਤੁਸੀਂ ਲਾ ਲਓ ਕਿ ਅਸੀਂ ਕੁਛ ਖਰੀਦਦੇ ਹਾਂ ਉਹ ਵੀ ਗੂਗਲ 'ਤੇ ਅਤੇ ਜਿਹਨੂੰ ਕਹਿੰਦੇ ਉਹਦੇ ਨਾਲ ਮਤਲਬ ਕਿ ਲੋਕ ਬੱਚਿਆਂ ਨੂੰ ਸਕੂਲ ਦਾ ਕੰਮ ਹਰ ਚੀਜ਼ ਕਿਸੇ ਨੂੰ ਕੁਛ ਲੈਣ ਦੇਣ ਓਨਲਾਈਨ ਹਰ ਚੀਜ਼ ਗੂਗਲ ਮਤਲਬ ਕਿ ਓਨਲਾਈਨ ਚੱਲਦੀ ਆ ਅਤੇ ਇਹਦੇ ਨਾਲ ਸਾਨੂੰ ਮਤਲਬ ਕਿ ਬਹੁਤ ਚੀਜ਼ਾਂ ਮੈਂ ਸਿੱਖਣ ਨੂੰ ਮਿਲੀਆਂ ਹਨ ਅਤੇ ਇਹਦੇ ਨਾਲ ਮਤਲਬ ਕਿ ਬੱਚਿਆਂ ਦੇ ਸਕੂਲ ਦੀ ਅੱਜਕਲ੍ਹ ਪੜ੍ਹਾਈ ਵੀ ਓਨਲਾਈਨ ਹੋ ਰਹੀ ਆ ਕਰੋਨਾ ਦੀ ਵਜ੍ਹਾ ਨਾਲ ਬੱਚਿਆ ਦੀ ਪੜ੍ਹਾਈ ਵੀ ਓਨਲਾਈਨ ਹੋ ਰਹੀ ਆ ਕਰੋਨਾ ਤਾਂ ਖਤਮ ਹੋ ਗਿਆ ਪਰ ਸਕੂਲ ਦੇ ਵਿੱਚ ਗਰੁੱਪ ਬਣੇ ਵੀ ਸੀ ਨਾ ਓਨਲਾਈਨ ਉਹ ਵੀ ਹੋ ਰਿਹਾ ਅਤੇ ਬਾਕੀ ਮਤਲਬ ਕਿ ਇਹਦੇ ਨਾਲ ਕਾਫੀ ਤਰੱਕੀ ਕੀਤੀ ਹੈ ਇੰਟਰਨੈਟ ਨੇ ਇੰਟਰਨੈਟ ਤੋਂ ਹੁਣ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਚਾਹੇ ਕੁਛ ਵੀ ਕੱਢਣਾ ਹੋਏ ਸਭ ਵੈਬਸਾਈਟ ਤੋਂ ਕੱਢਦੇ ਹਾਂ ਵੈਬਸਾਈਟ ਇੱਕ ਪੇਜ ਹੁੰਦਾ ਉਹਦੇ ਤੋਂ ਕਰਦੇ ਹਾਂ ਅਤੇ ਸਾਨੂੰ ਮਤਲਬ ਕਿ ਸਿੱਖਣ ਨੂੰ ਮਿਲਦਾ ਹੈ ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇੰਟਰਨੈਟ ਤੋਂ ਬਹੁਤ ਕੁਛ ਹੈ ਕਿ ਜੋ ਕੁਛ ਹੈ ਸਿਖਣ ਨੂੰ ਮਿਲਦਾ ਹੈ ਠੀਕ ਹੈ ਠੀਕ